ਮੇਰਾ ਪਸੰਦੀਦਾ ਕਲਾਕਾਰ ਹੈਗਾ ਆ ਸ਼੍ਰੀ ਅਭਿਸ਼ੇਕ ਸਿੰਘ ਜੀ ਜਿਹੜੇ ਕਿ ਬਹੁਤ ਪ੍ਰਸਿੱਧ ਆਰਟਿਸਟ ਹੈਗੇ ਨੇ ਬਹੁਤ ਸੋਹਣੇ ਆ ਕਲਾ ਬਹੁਤ ਸੋਹਣੇ ਡਰੋਇੰਗ ਬਣਾਉਂਦੇ ਨੇ ਉਹ ਜ਼ਿਆਦਾਤਰ ਪੋਟਰੇਟ ਆਰਟ ਕਰਦੇ ਨੇ ਅਤੇ ਮੈਨੂੰ ਉਹਨਾਂ ਦੀ ਉਹਨਾਂ ਤੋਂ ਹੀ ਮਤਲਬ ਪ੍ਰਭਾਵਿਤ ਹੋ ਕੇ ਮੈਂ ਵੀ ਪੋਰਟਰੇਟ ਆਰਟ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਂ ਉਹਨਾਂ ਵਰਗਾ ਤਾਂ ਨਹੀਂ ਕਰ ਸਕਦੀ ਪਰ ਉਹਨਾਂ ਦੇ ਕੰਮ ਦੇਖਣ ਤੋਂ ਬਾਅਦ ਉਹਨਾਂ ਦਾ ਕੰਮ ਪਸੰਦ ਕਰਨ ਤੋਂ ਬਾਅਦ ਮੈਨੂੰ ਵੀ ਇੱਛਾ ਹੋਈ ਕਿ ਮੈਂ ਵੀ ਕਰਾਂ ਮੈਂ ਵੀ ਥੋੜ੍ਹਾ ਬਹੁਤ ਉਹਨਾਂ ਤੋਂ ਉਹਨਾਂ ਦੀਆਂ ਵੀਡੀਓਜ ਦੇਖ ਕੇ ਕੁਛ ਨਾ ਕੁਛ ਸਿੱਖ ਕੇ ਕਿਤੇ ਨਾ ਕਿਤੇ ਕੁਝ ਨਾ ਕੁਝ ਉਹਨਾਂ ਦੇ ਨਕਸ਼ੇ ਕਦਮ ਅਨੁਸਾਰ ਕਰ ਰਹੀ ਹਾਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਆ